ਹਾਂ ਮੈਨੂੰ ਡਾਂਸ ਸ਼ੈਲੀ ਸਿੱਖਣ ਅਤੇ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਜਿਵੇਂ ਕਿ ਮੈਂ ਡਾਂਸ ਸ਼ੈਲੀ ਆਪਣੇ ਹੀ ਖੇਤਰ ਤੋਂ ਸਿੱਖੀ ਹੈ ਜਿੱਥੇ ਕਿ ਮੈਂ ਪੰਜਾਬੀ ਨ੍ਰਿੱਤਯ ਸਿੱਖਿਆ ਹੈ ਜਿਵੇਂ ਕਿ ਭੰਗੜਾ ਹੋ ਗਿਆ ਗਿੱਧਾ ਅਤੇ ਮੈਂ ਹਿਪ ਹੋਪ ਵੀ ਸਿੱਖਿਆ ਆ ਉਹ ਵੀ ਇਸੀ ਖੇਤਰ ਤੋਂ ਅਤੇ ਮੈਂ ਉਹਨੂੰ ਪ੍ਰਦਰਸ਼ਿਤ ਵੀ ਕੀਤਾ ਹੈ ਜਿਵੇਂ ਕਿ ਰਿਐਲਿਟੀ ਟੀ ਵੀ ਸ਼ੋਜ ਹ ਵਿੱਚ ਹੋ ਗਿਆ ਅਤੇ ਕਿਸੀ ਡਾਂਸ ਪ੍ਰਫੋਰਮਸਸ 'ਚ ਹੋ ਗਿਆ ਜਿੱਥੇ ਕਿ ਕੋਂਟੈਸਟ ਲੱਗੇ ਹੋਣ ਜਾਂ ਜਿਨ੍ਹਾਂ ਨੇ ਮੈਨੂੰ ਪਾਰਟੀਸਪੇਸ਼ਨ ਕਰਨ ਦਾ ਮੌਕਾ ਮਿਲਿਆ ਹੈ ਮੈਂ ਉੱਥੇ ਵੀ ਡਾਂਸ ਆਪਣਾ ਪ੍ਰਦਰਸ਼ਿਤ ਕੀਤਾ ਹੈ ਅਤੇ ਵੱਖ ਵੱਖ ਖੇਤਰਾਂ 'ਚ ਪ੍ਰਦਰਸ਼ਿਤ ਕੀਤਾ ਹੈ ਅਤੇ ਮੈਂ ਉਹਨੂੰ ਸਿੱਖਿਆ ਵੀ ਹੈ ਅਤੇ ਇਹ ਪ੍ਰਦਰਸ਼ਨ ਕਰਨ ਲਈ ਮੈਂ ਜਿਵੇਂ ਕਿ ਮੈਂ ਚੰਡੀਗੜ੍ਹ ਵੀ ਪ੍ਰਦਰਸ਼ਿਤ ਕੀਤਾ ਹੈ ਅਤੇ ਵੱਖ ਵੱਖ ਹੋਰ ਖੇਤਰਾਂ 'ਚ ਵੀ ਮੈਂ ਆਪਣਾ ਡਾਂਸ ਪ੍ਰਦਰਸ਼ਿਤ ਕੀਤਾ ਹੈ ਜਿਵੇਂ ਕਿ ਭੰਗੜਾ ਗਿੱਧਾ ਅਤੇ ਹਿਪ ਹੋਪ ਸਭ ਤੋਂ ਵੱਧ ਮੈਂ ਭੰਗੜਾ ਹੀ ਕੀਤਾ ਹੈ ਪ੍ਰਦਰਸ਼ਿਤ ਅਤੇ ਉਹ ਮੇਰੇ ਲਈ ਬਹੁਤ ਹੀ ਵਧੀਆ ਰਿਹਾ ਹੈ ਅਤੇ ਮੈਨੂੰ ਉਹ ਭੰਗੜਾ ਬਹੁਤ ਹੀ ਜ਼ਿਆਦਾ ਪਸੰਦ ਹੈ ਅਤੇ ਕਈ ਲੋਕਾਂ ਨੇ ਉਹਨੂੰ ਪਰ ਐਪਰੀਸ਼ੀਏਟ ਵੀ ਕੀਤਾ ਹੈ ਉਸ ਵਿੱਚ ਭੰਗੜੇ ਵਿੱਚ ਅਤੇ ਮੈਂ ਹਿਪ ਹੋਪ ਵੀ ਸਿੱਖਿਆ ਹੈ ਅਤੇ ਮੈਂ ਉਹਨੂੰ ਵੀ ਪ੍ਰਦਰਸ਼ਿਤ ਕੀਤਾ ਹੈ